ਮੈਨੂੰ ਮਿਠਾਈਆਂ ਦਾ ਬਹੁਤ ਸ਼ੌਂਕ ਹੈ ਇਸ ਕਰਕੇ ਮੈਂ ਕਿਸੇ ਨਾਲ ਕੋਈ ਨਾ ਕੋਈ ਦਿਨ ਕੋਈ ਮਿਠਾਈ ਆਰਡਰ ਕਰਦੀ ਰਹਿੰਦੀ ਹਾਂ ਇਸ ਕਰਕੇ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਆਰਡਰ ਕਰਨਾ ਮੈਂ ਕਿਸੇ ਰੈਸਟੋਰੈਂਟ ਤੋਂ ਆਪਣੇ ਲਈ ਖਾਣਾ ਮੰਗਵਾਇਆ ਜਿਸ ਵਿੱਚ ਸ਼ਾਹੀ ਪਨੀਰ ਮਲਾਈ ਕੋਫਤਾ ਅਤੇ ਨਾਲ ਦਾਲ ਮਖਣੀ ਮੰਗਵਾਈ ਔਰ ਮੇਰਾ ਜੀ ਕੀਤਾ ਕਿ ਮੈਂ ਇਸਦੇ ਨਾਲ ਨਾਲ ਕੋਈ ਮਿਠਿਆਈ ਵੀ ਮੰਗਵਾਵਾਂ ਇਸ ਵਿੱਚ ਮੈਂ ਕੇਕ ਹਲਵਾ ਰਸ ਗੁਲਾਬ ਜਾਮਨ ਆਡਰ ਕੀਤੇ ਕਿਉਂਕਿ ਉਸ ਦਿਨ ਮੇਰੇ ਘਰ ਮੇਰੇ ਰਿਸ਼ਤੇਦਾਰ ਆਏ ਹੋਏ ਹਨ ਔ ਆਏ ਹੋਏ ਸਨ ਜਿਸ ਕਰਕੇ ਮੈਨੂੰ ਖਾਣਾ ਬਾਹਰ ਤੋਂ ਆਰਡਰ ਕਰਨਾ ਪਿਆ ਮੈਂ ਬਾਹਰੋਂ ਆਰਡਰ ਮੰਗਵਾਇਆ ਔਰ ਮੈਂ ਕਿਆ ਮੈਂ ਮਿਠਾਈ ਵਿੱਚ ਕਿਆ ਮਿਠਾਈ ਲਈ ਵੀ ਆਰਡਰ ਕਰ ਦਿੱਤਾ ਵਿੱਚ ਮੈਨੂੰ ਮਿਠਾਈ ਖਾਣਾ ਬਹੁਤ ਪਸੰਦ ਮੇਰੇ ਰਿਸ਼ਤੇਦਾਰ ਵੀ ਬਹੁਤ ਹੀ ਪਸੰਦ ਕਰਦੇ ਨੇ ਜਿੱਥੋਂ ਮੈਂ ਹਮੇਸ਼ਾ ਮੰਗਵਾਉਂਦੀ ਮੰਗਵਾਉਂਦੀ ਸੀ ਉਹਨਾਂ ਨੇ ਇਸ ਵਿੱਚ ਮਤਲਬ ਉਸ ਰੈਸਟੋਰੈਂਟ ਤੋਂ ਉਹਨਾਂ ਨੇ ਮੈਨੂੰ ਬਹੁਤ ਹੀ ਮਤਲਬ ਸਹੀ ਤਰੀਕੇ ਨਾਲ ਮਿਠਾਈਆਂ ਦੇ ਰੋਟੀ ਖਾਣੇ ਦੇ ਨਾਲ ਨਾਲ ਮਿਠਾਈਆਂ ਵੀ ਪੈਕ ਕਰਕੇ ਭੇਜੀਆਂ ਇਸ ਵਿੱਚ ਮੇਰੇ ਘਰ ਆਏ ਰਿਸ਼ਤੇਦਾਰਾਂ ਨੇ ਖਾਣੇ ਨੂੰ ਵੀ ਬਹੁਤ ਪਸੰਦ ਕੀਤਾ ਅਤੇ ਔਰ ਮਿਠਾਈਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਇਸ ਕਰਕੇ ਮੈਂ ਤੁਹਾਨੂੰ ਇਹ ਰਾਏ ਦੇਵਾਂਗੀ ਕਿ ਤੁਸੀਂ ਵੀ ਖਾਣੇ ਦੇ ਨਾਲ ਨਾਲ ਮਿਠਾਈਆਂ ਨੂੰ ਵੀ ਸ਼ਾਮਿਲ ਕਰਿਆ ਕਰੋ ਧੰਨਵਾਦ